ਪੰਜਾਬ 'ਚ ਬਹੁਤ ਜ਼ਿਆਦਾ ਬਦਲਾਅ ਆ ਗਿਆ ਹੈਗਾ ਪਹਿਲਾਂ ਪੰਜਾਬ 'ਚ ਕੱਚੇ ਘਰ ਸੀਗੇ ਹੈ ਨਾ ਕੱਚੇ ਜਿਹੜੇ ਮਿੱਟੀ ਦੇ ਸੀਗੇ ਉਹਦੇ 'ਤੇ ਖਾਣਾ ਬਣਾਇਆ ਚੁੱਲਿਆਂ 'ਤੇ ਖਾਣਾ ਬਣਾਇਆ ਜਾਂਦਾ ਸੀਗਾ ਪਹਿਲਾਂ ਅੱਜ ਕੱਲ੍ਹ ਪੰਜਾਬ ਦੇ ਜਿਹੜੇ ਪਿੰਡ ਹੈਗੇ ਹੈ ਉਹ ਜਿਹੜੇ ਹੈਗੇ ਹੈ ਪੱਕੇ ਇੱਟ ਵਾਲੇ ਹੈਗੇ ਹੈ ਸਿਲੰਡਰ 'ਤੇ ਰੋਟੀ ਬਣਾਉਂਦੇ ਹੈਗੇ ਹੈ ਅਤੇ ਪਹਿਲਾਂ ਜਿਹੜੇ ਹੈਗੇ ਆ ਖੇਤਾਂ 'ਚ ਜਿਹੜਾ ਹੈਗਾ ਪਿਓਰ ਜਿਹੜਾ ਔਰਗੈਨਿਕ ਹੁੰਦਾ ਫਰਟੀਲਾਈਜਰ ਉਹਨੂੰ ਹੀ ਯੂਸ ਕਰਦੇ ਸੀਗੇ ਜਿਹੜਾ ਮੱਝਾਂ ਦਾ ਜਿਹੜਾ ਡੰਗ ਹੁੰਦਾ ਉਹਨੂੰ ਯੂਸ ਕਰਦੇ ਸੀ ਅੱਜ ਕੱਲ੍ਹ ਹੈਗੇ ਜਿਹੜੇ ਆ ਗਏ ਹੈ ਕੈਮੀਕਲ ਫਰਟੀਲਾਈਜਰ ਹੈਗੇ ਹੈ ਉਹ ਯੂਸ ਕਰਦੇ ਹੈਗੇ ਆ ਉਹਦੇ ਨਾਲ ਜਿਹੜਾ ਹੈਗਾ ਜਿਹੜੀ ਫ਼ਸਲ ਹੁੰਦੀ ਹੈ ਛੇਤੀ ਤਾਂ ਬਣ ਜਾਂਦੀ ਆ ਲੇਕਿਨ ਉਹਦੇ 'ਚ ਉੰਨੀ ਤਾਕਤ ਨਹੀਂ ਹੁੰਦੀ ਇੰਨੀ ਤਾਕਤ ਨਾ ਹੋਣ ਕਰਕੇ ਉਹਦੇ 'ਚ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੋ ਜਾਂਦਾ ਲੋਕਾਂ ਦਾ ਉਹਨਾਂ 'ਚ ਇੰਨੀ ਤਾਕਤ ਨਹੀਂ ਹੁੰਦੀ ਲੋਕ ਉਹਨੂੰ ਖਾਂਦੇ ਉਹਨਾਂ ਤੋਂ ਇੰਨੀ ਸ਼ਕਤੀ ਨਹੀਂ ਮਿਲਦੀ ਉਹਨਾਂ ਨੂੰ ਲੇਕਿਨ ਤਾਂ ਵੀ ਹੁਣ ਢਿੱਡ ਭਰਨਾ ਹੈਗਾ ਤਾਂ ਲੋਕ ਖਾਂਦੇ ਹੈਗੇ ਹੈ ਹੈ ਨਾ ਪਹਿਰਾਵੇ 'ਚ ਬਹੁਤ ਜ਼ਿਆਦਾ ਫ਼ਰਕ ਆ ਗਿਆ ਪਹਿਲਾਂ ਸਾਦੇ ਕੱਪੜੇ ਪਾਉਂਦੇ ਸੀ ਅੱਜ ਕੱਲ੍ਹ ਜੀਨ ਪੈਂਟਾ ਪਾਉਂਦੇ ਹੈਗੇ ਆ ਸਾਰੇ ਜੀਨ ਪੈਂਟਾਂ ਪਾਉਂਦੇ ਆ ਪਹਿਲਾਂ ਸਾਦੇ ਕੱਪੜੇ ਪਾਉਂਦੇ ਸੀਗੇ ਸਾਦੇ ਕੱਪੜਿਆਂ 'ਚ ਗਰਮੀ ਘੱਟ ਲੱਗਦੀ ਸੀਗੀ ਹੈ ਨਾ ਗਰਮੀਆਂ ਬਿਨ੍ਹਾਂ ਪੱਖੇ ਤੋਂ ਵੀ ਰਿਹਾ ਜਾ ਸਕਦਾ ਸੀ ਅੱਜ ਕੱਲ੍ਹ ਗਰਮੀ ਇੰਨੀ ਵੱਧ ਗਈ ਹੈਗੀ ਹੈ ਕਿ ਏ ਸੀ ਹੈਗਾ ਏ ਸੀ ਤੋਂ ਬਗੈਰ ਰਿਹਾ ਹੀ ਨਹੀਂ ਜਾ ਸਕਦਾ ਸਾਰੇ ਜਿਹੜੇ ਹੈਗੇ ਹੈ ਲਗਭਗ ਸਾਰੇ ਘਰਾਂ 'ਚ ਏ ਸੀ ਹੁੰਦਾ ਹੈ ਸਕੂਲ ਕਾਲਜਾਂ 'ਚ ਕਿੰਨੇ ਏ ਸੀ ਹੁੰਦੇ ਆ ਉਹਦੇ ਕਰਕੇ ਇੰਨੀ ਗਰਮੀ ਵੱਧ ਚੁੱਕੀ ਅੱਜ ਕੱਲ੍ਹ ਕਿ ਬਸ ਹੱਦ ਹੀ ਹੋ ਗਈ ਹੈ